ਜਦੋਂ ਅਸੀਂ ਕਿਸੇ ਵੀ ਚੀਜ਼ ਨੂੰ ਬਣਾਉਂਦੇ ਹਾਂ ਜਿਹੜੀ ਕਿ ਆਪਾਂ ਕਦੇ ਵੀ ਬਣਾਈ ਨਾ ਹੋਵੇ ਤਾਂ ਉਸਨੂੰ ਬਣਾਉਣ ਲਈ ਡਰ ਮਹਿਸੂਸ ਹੁੰਦਾ ਹੀ ਹੈ ਉਦਾਹਰਨ ਦੇ ਤੌਰ 'ਤੇ ਜੇਕਰ ਮੈਂ ਖੀਰ ਬਣਾਉਂਦੀ ਹਾਂ ਤਾਂ ਮੈਨੂੰ ਇਹ ਡਰ ਹੁੰਦਾ ਕਿ ਇਸ ਵਿੱਚ ਚਾਵਲ ਜ਼ਿਆਦਾ ਨਾ ਪੈ ਜਾਣ ਜਾਂ ਚੀਨੀ ਜ਼ਿਆਦਾ ਨਾ ਪੈ ਜਾਏ ਘੱਟ ਨਾ ਪੈ ਜਾਏ ਫਿਰ ਦੁੱਧ ਦਾ ਵੀ ਥੋੜ੍ਹਾ ਜਿਹਾ ਹਿਸਾਬ ਰੱਖਣਾ ਪੈਂਦਾ ਹੈ ਅਗਰ ਥੋੜ੍ਹੀ ਜਿਹੀ ਵੀ ਚੀਜ਼ ਗਲਤ ਹੋ ਗਈ ਤਾਂ ਕਿਤੇ ਸਾਰੀ ਖੀਰ ਤਾਂ ਨਹੀਂ ਖਰਾਬ ਹੋ ਜਾਏਗੀ ਇਹ ਡਰ ਹਮੇਸ਼ਾ ਮਨ ਵਿੱਚ ਆਉਂਦਾ ਹੀ ਹੈ ਕਿਉਂਕਿ ਅਗਰ ਕੋਈ ਚੀਜ਼ ਵੀ ਘੱਟ ਵੱਧ ਪੈ ਗਈ ਤਾਂ ਉਹ ਖਰਾਬ ਹੋਣ ਦਾ ਖਤਰਾ ਥੋੜ੍ਹਾ ਜਿਹਾ ਵੱਧ ਜਾਂਦਾ ਹੈ ਇਸ ਲਈ ਥੋੜ੍ਹਾ ਜਿਹਾ ਗੈਂਸ ਦੇ ਵਿੱਚ ਵੀ ਹੁੰਦਾ ਹੈ ਕਿ ਗੈਂਸ ਘੱਟ ਅਤੇ ਆਪਾਂ ਉਹ ਬਣਾਉਣੀ ਹੈ ਜਾਂ ਗੈਸ ਤੇਜ਼ ਕਰਕੇ ਉਹ ਬਣਾਉਣੀ ਹੈ ਅਤੇ ਜਦੋਂ ਬਣ ਜਾਏ ਤਾਂ ਕਿਵੇਂ ਪਤਾ ਲੱਗੇਗਾ ਕਿ ਇਹ ਬਣ ਚੁੱਕੀ ਹੈ ਇਸ ਦਾ ਡਰ ਮੈਨੂੰ ਰਹਿੰਦਾ ਹੈ ਮੈਂ ਕਿਸ ਤਰ੍ਹਾਂ ਖੀਰ ਬਣਾਉਣੀ ਹੈ ਇਹ ਡਰ ਦੂਰ ਕਰਨ ਲਈ ਮੈਂ ਬਹੁਤ ਕੁਛ ਸੋਚਦੀ ਹਾਂ ਅਤੇ ਬਹੁਤ ਕੁਛ ਪੁੱਛਦੀ ਵੀ ਹਾਂ ਕਿ ਇਹ ਕਿਵੇਂ ਬਣਾਉਣੀ ਹੈ ਕੀ ਚੀਜ਼ ਕਿਵੇਂ ਕਰਾਂ ਤਾਂ ਕਿ ਇਹ ਖਰਾਬ ਨਾ ਹੋਏ ਬਹੁਤ ਡਰ ਮਹਿਸੂਸ ਹੁੰਦਾ ਹੈ ਜਦੋਂ ਮੈਂ ਕੋਈ ਨਵੀਂ ਚੀਜ਼ ਬਣਾਉਣ ਦੀ ਕੋਸ਼ਿਸ਼ ਕਰਦੀ ਹਾਂ